ਅੱਜ ਦੇ ਸਮੇਂ ਵਿੱਚ ਗੁਰਦਾਸਪੁਰ ਜ਼ਿਲੇ ਵਿੱਚ ਬਹੁਤ ਜ਼ਿਆਦਾ ਸਕੂਲ ਬਣਾਏ ਗਏ ਹਨ ਜਿਹੜੇ ਬੱਚਿਆਂ ਵਾਸਤੇ ਬਣਾਏ ਗਏ ਹਨ ਤਾਂ ਕਿ ਬੱਚੇ ਉੱਥੇ ਜਾ ਕੇ ਸਿਕਸ਼ਾ ਲੈ ਸਕਣ ਅਤੇ ਉਹਨਾਂ ਨੂੰ ਅੱਗੇ ਆਪਣੇ ਭਵਿਸ਼ ਵਾਸਤੇ ਨਵੀਂ ਤੋਂ ਨਵੀਂ ਇਹ ਚੀਜ਼ਾਂ ਵਿੱਚ ਉਮੀਦਾਂ ਮਿਲ ਸਕਣ ਪਰ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਿੱਖਿਆ ਵਾਸਤੇ ਤਾਂ ਚੀਜ਼ਾਂ ਬਣਾਈਆਂ ਗਈਆਂ ਹਨ ਉਸ ਦੇ ਨਾਲ ਕਿਸਾਨਾਂ ਵਾਸਤੇ ਮਦਦ ਕਰਨ ਵਾਸਤੇ ਉਹਨਾਂ ਨੂੰ ਕਾਫੀ ਜ਼ਿਆਦਾ ਰੁਜ਼ਗਾਰ ਵਾਸਤੇ ਮਦਦ ਕਰਨ ਵਾਸਤੇ ਵੀ ਕੰਮ ਦਿੱਤੇ ਜਾਂਦੇ ਹਨ ਅਤੇ ਪਰ ਚੰਗੀ ਚੀਜ਼ਾਂ ਤਾਂ ਗੁਰਦਾਸਪੁਰ ਵਿੱਚ ਆ ਆਏ ਹੀ ਕਰਦੀਆਂ ਹਨ ਪਰ ਉਸ ਦੇ ਨਾਲ ਹੀ ਬੁਰੀ ਚੀਜ਼ਾਂ ਵੀ ਆਏ ਕਰਦੀਆਂ ਨੇ ਜਿਸ ਜਿੱਦਾਂ ਡਰੱਗ ਦਾ ਉਤਪਾਦਨ ਬਹੁਤ ਜ਼ਿਆਦਾ ਵੱਧ ਰਿਹਾ ਹੈ ਗੁਰਦਾਸਪੁਰ ਜ਼ਿਲ੍ਹੇ ਵਿੱਚ ਡਰੱਗ ਇੱਦਾਂ ਦੀ ਪ੍ਰੋਬਲਮ ਹੈ ਗੁਰਦਾਸਪੁਰ ਜ਼ਿਲ੍ਹੇ ਵਿੱਚ ਜਿਹਦੇ ਵਾਸਤੇ ਪੁਲਿਸ ਪ੍ਰਸ਼ਾਸਨ ਵੀ ਬੜੇ ਜ਼ਿਆਦਾ ਔਖੇ ਸਟੈਪ ਲੈ ਰਹੀ ਹਨ ਤਾਂ ਕਿ ਇਸ ਨੂੰ ਜੜ ਤੋਂ ਖਤਮ ਕੀਤਾ ਜਾਏ ਪਰ ਜ ਪਰ ਆਹ ਬਹੁਤ ਹੀ ਜ਼ਿਆਦਾ ਖਤਰਨਾਕ ਚੀਜ਼ ਹਨ ਜਿਹਦੇ ਕਾਰਨ ਹਰ ਕਿਸੇ ਨੂੰ ਸਾਵਧਾਨੀ ਨਾਲ ਐਕਸ਼ਨ ਲੈਣਾ ਪੈਂਦਾ ਹੈ ਕਿਉਂਕਿ ਇਸਦੀ ਜਦੋਂ ਇੱਕ ਵਾਰ ਕਿ ਬੰਦੇ ਨੂੰ ਲੱਤ ਲੱਗ ਜਾਵੇ ਤਾਂ ਉਹ ਦਾ ਉਸ ਨੂੰ ਛੱਡਣਾ ਬੜਾ ਜ਼ਿਆਦਾ ਮੁਸ਼ਕਿਲ ਹੁੰਦਾ ਹੈ ਇਸ ਲੀਏ ਆਪਾਂ ਬੇਨਤੀ ਕਰਦੇ ਹਨ ਕਿ ਜੇ ਵੀ ਕਿਸੇ ਬੰਦੇ ਨੂੰ ਇਸ ਬਾਰੇ ਪਤਾ ਹੋ ਤਾਂ ਉਹ ਸਿੱਧਾ ਪੁਲਿਸ ਪ੍ਰਸ਼ਾਸਨ ਨੂੰ ਫੋਨ ਕਰੇ ਤਾਂ ਪੁਲਸ ਇਸ ਲੀਏ ਪੁਲਸ ਪ੍ਰਸ਼ਾਸਨ ਨੇ ਵੀ ਇਸ ਉੱਤੇ ਇਨਾਮ ਰੱਖੇ ਹੋਏ ਹਨ ਤਾਂ ਕਿ ਉਹ ਹਮੇਸ਼ਾਂ ਇੱਥੇ ਬਰੀਕੀ ਨਾਲ ਅੱਖ ਰੱਖ ਸਕਣ